ਸਾਡੇ ਇਲਾਕੇ ਵਿੱਚ ਆਸਪਾਸ ਸਰਕਾਰੀ ਸੀਂਅਰ ਸੈਕੰਡਰੀ ਸਕੂਲ ਖਰੜ੍ਹ ਸਥਿਤ ਹੈ ਅਤੇ ਰਿਆਤ ਬਹਾਰਾ ਕੋਲੇਜ ਅਤੇ ਹੋਰ ਕੋਲੇਜ ਹਨ ਸਾਡੇ ਪਰਿਵਾਰ ਵਿੱਚੋਂ ਇਸ ਸਮੇਂ ਮੇਰੀ ਬੇਟੀ ਹੀ ਪੜ੍ਹ ਰਹੀ ਹੈ ਜੋ ਕਿ ਬੀ ਐੱਸ ਸੀ ਨਰਸਿੰਗ ਕਰ ਰਹੀ ਹੈ